ਹਾਂਜੀ ਗੁੱਡ ਆਫਟਰਨੂਨ ਮੈਮ ਹਾਂਜੀ ਮੈਮ ਮੈਂ ਇਨਕੁਆਰਇਰੀ ਕਰਨੀ ਸੀਗੀ ਕਿ ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਲਈ ਟ੍ਰੇਨ ਆਉਂਦੀ ਹੈ ਉਹ ਕਿਹੜੀ ਟ੍ਰੇਨ ਆ ਔਰ ਕੀ ਟਾਈਮਿੰਗ ਹੈ ਉਹਦੀ ਅੱਛਾ ਜੀ ਹਾਂਜੀ ਹਾਂਜੀ ਸ਼ਤਾਬਦੀ ਦੇ ਵਿੱਚ ਏ ਸੀ ਹਾਂਜੀ ਅੱਛਾ ਜੀ ਹਾਂਜੀ ਜਿੱਦਾਂ ਕੱਲ੍ਹ ਸੰਡੇ ਹੈਗਾ ਜੇ ਆਪਾਂ ਸੰਡੇ ਨਹੀਂ ਆਪਾਂ ਮੰਡੇ ਟਿਊਸਡੇ ਦੇਖਦੇ ਹੈ ਉਹਨਾਂ ਦੇ ਕੋਲ ਸੀਟ ਟਿਊਸਡੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਮੈਮ ਇਹਦੇ ਕੀ ਆ ਚਾਰਜਿਸ ਨੇ ਕਿੰਨੇ ਦਾ ਆਪਾਂ ਨੂੰ ਉਹ ਦੇਣਾ ਪਏਗਾ ਟਿਕਟ ਕਿੰਨੀ ਹੈ ਹਾਂਜੀ ਸਮਟਾਈਮ ਕੀ ਹੁੰਦਾ ਜੀ ਆਪਾਂ ਜੇ ਇਹਨੂੰ ਕੈਂਸਲ ਕਰਵਾਉਣਾ ਤਾਂ ਆਪਾਂ ਨੂੰ ਰੀਫੰਡ ਮਿਲੇਗਾ ਉਹਨੂੰ ਹਾਂਜੀ ਅੱਛਾ ਜੀ ਕਿੰਨੇ ਆਪਾਂ ਨੂੰ ਅਮਾਊਟ ਹੋਏਗੀ ਰੀਫੰਡ ਹਾਂਜੀ ਹਾਂਜੀ ਜਿੱਦਾਂ ਹੁਣ ਮੈਂ ਵਾਪਸੀ ਲਈ ਜਾਣਾ ਅੰਮ੍ਰਿਤਸਰ ਟੂ ਦਿੱਲੀ ਫਿਰ ਉਹਦੇ ਲਈ ਟ੍ਰੇਨ ਆਪਾਂ ਨੂੰ ਕਿਹੜੀ ਮਿਲੇਗੀ ਪੋਸੀਬਲ ਹੋਏਗੀ ਆਫਟਰ ਵਨ ਵੀਕ ਹਾਂਜੀ ਹਾਂਜੀ ਹਾਂਜੀ ਆਫਟਰਨੂਨ ਦੀ ਹੈ ਅੱਛਾ ਜੀ ਉਹਦੇ ਕੀ ਆਪਣੀ ਕਿੰਨੀ ਟਿਕਟ ਹੈ ਅੱਛਾ ਜੀ ਕੀ ਫਸਿਲਿਟੀਸ ਮਿਲਣਗੀਆਂ ਆਪਾਂ ਨੂੰ

ਅੱਛਾ ਜੀ ਔਰ ਨਾਈਟ ਅੱਛਾ ਜੀ ਹੋਰ ਕੀ ਮਿਲਣਗੀਆਂ ਸਾਨੂੰ ਉਹ ਕੋਈ ਬੈੱਡ ਸ਼ੀਟ ਵਗੈਰਾ ਕੋਈ ਉਹ ਪਿੱਲੋ ਵਗੈਰਾ ਸਾਰਾ ਕੁਛ ਮਿਲੇਗਾ ਹਾਂਜੀ ਅਗਰ ਸਾਡੇ ਬੱਚੇ ਨਾਲ ਹੈਗੇ ਹੈ ਅਤੇ ਉਹਨਾਂ ਦੇ ਲਈ ਸਾਨੂੰ ਕਈ ਪ ਪ੍ਰੋਪਰ ਫਸਿਲਿਟੀ ਮਿਲ ਜਾਏਗੀ ਨਾ ਵੋਸ਼ਰੂਮ ਵਗੈਰਾ ਕਲੀਨ ਹੋਣਗੇ ਹਾਂਜੀ ਹਾਂਜੀ ਅਤੇ ਉਹਦੀ ਕਿੰਨੀ ਟਿਕਟ ਲੱਗੇਗੀ ਠੀਕ ਹੈ ਮੈਮ ਅਤੇ ਮੈਮ ਹੋਰ ਆਪਾਂ ਨੂੰ ਕੀ ਫਸਿਲਿਟੀ ਮਿਲੇਗੀ ਇਹਦੇ ਵਿੱਚ ਹਾਂਜੀ ਮੈਮ ਔਰ ਟ੍ਰੇਨ ਕਦੀ ਲੇਟ ਦਾ ਇਸ਼ੂ ਹੋਏਗਾ ਤਾਂ ਸਾਨੂੰ ਕਿੱਦਾਂ ਪਤਾ ਚੱਲੇਗਾ ਹਾਂਜੀ ਮੈਮ ਪਲੀਜ਼ ਸਾਈਟ ਦੱਸ ਦਓਗੇ ਹਾਂਜੀ ਹਾਂਜੀ ਠੀਕ ਹੈ ਮੈਮ ਮਿਲ ਗਈ ਮਿਲ ਗਈ ਹਾਂਜੀ ਮੈਮ ਕੋਈ ਟਾਈਮਿੰਗ ਦਾ ਕੋਈ ਇਸ਼ੂ ਹੋਇਆ ਪੀਲਜ਼ ਇਨਫੋਰਮ ਕਰ ਸਕਦੇ ਹੋ ਠੀਕ ਆ ਥੈਂਕ ਯੂ ਮੈਮ ਓਕੇ ਥੈਂਕ ਯੂ ਸੋ ਮਚ